ਮੇਰੀ ਸਭ ਤੋਂ ਮਨ ਪਸੰਦ ਖੇਡ ਵੋਲੀਬੋਲ ਹੈ ਐਂਡ ਛੋਟੇ ਹੁੰਦੇ ਤੋਂ ਹੀ ਮੈਂ ਵੋਲੀਬੋਡ ਖੇਡਦਾ ਆ ਰਿਹਾ ਹਾਂ ਸਕੂਲ ਵਿੱਚ ਜਦੋਂ ਵੀ ਮੈਚ ਹੁੰਦਾ ਸੀਗਾ ਜਾਂ ਜਾਂ ਕਿ ਕੋਈ ਫਰੀ ਪੀਰੀਅਡ ਹੁੰਦਾ ਸੀਗਾ ਅਸੀਂ ਹਮੇਸ਼ਾ ਅਸੀਂ ਆਪਣੇ ਅਧਿਆਪਕ ਨੂੰ ਕਹਿੰਦੇ ਸੀ ਕਿ ਸਾਨੂੰ ਬਾਹਰ ਖੇਡਣ ਲਈ ਲੈ ਕੇ ਚੱਲੋ ਅਤੇ ਮੈਂ ਅਤੇ ਮੇਰੇ ਆਪਣੇ ਮਿੱਤਰ ਇੱਕ ਥਾਂ ਹੋ ਜਾਂਦੇ ਸਨ ਅਤੇ ਮੇਰੇ ਜੋ ਮਿੱਤਰ ਨਹੀਂ ਸਨ ਉਹ ਦੂਜੀ ਟੀਮ ਵਿੱਚ ਹੋ ਜਾਂਦੇ ਸਨ ਅਤੇ ਅਸੀਂ ਹਮੇਸ਼ਾ ਮੈਚ ਲੈ ਕੇ ਆਉਂਦੇ ਸਨ ਐਂਡ ਹਮੇਸ਼ਾ ਅਸੀਂ ਮੈਚ ਜਿੱਤਦੇ ਵੀ ਸਨ ਜਿਸ ਕਰਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਸੀ